ਹੈਲੋ ਹਾਂਜੀ ਭਾਅ ਜੀ

ਹਾਂਜੀ ਹਾਂਜੀ ਭਾਅ ਜੀ ਮੈਂ ਦੇਖਿਆ ਜੀ ਹਾਂਜੀ ਹਾਂਜੀ ਭਾਅ ਜੀ ਦੱਸਿਆ ਸੀ ਉਹਨਾ ਨੇ ਦੱਸਿਆ ਸੀ ਭਾਜੀ ਤੁ ਆਏ ਹੋਏ ਤੁਸੀਂ ਠੀਕ ਹੈ ਜੀ ਭਾਅ ਜੀ ਇੱਥੇ ਕਈ ਕਈ ਕਈ ਸਵੀਟ ਸ਼ੋਪਸ ਨੇ ਬਟ ਜਿਹੜੀਆਂ ਫੇਮਸ ਨੇ ਉਹ ਹੈਗੀਆ ਨੇ ਅਨੰਤ ਫਾਸਟ ਫੂਡ ਆ ਜੀ ਜਿੱਥੇ ਬੜਾ ਵਧੀਆ ਹੈਗਾ ਹਾਂਜੀ ਉੱਥੇ ਵਧੀਆ ਬਰਗਰ ਮਨਚੂਰੀਅਨ ਸਭ ਤੋਂ ਵਧੀਆ ਮਿਲਦਾ ਆ ਫਿਰ ਬੀਕਾਨੇਰ ਦੇ ਆ ਜਾਓ ਜਿੱਥੇ ਸਾਰਾ ਹੀ ਪਿਓਰ ਦੇਸੀ ਘੀ ਦਾ ਬਣਦਾ ਆ ਓ ਕੋਈ ਮਿਲਾਵਟ ਨਹੀਂ ਮਿਲੇਗੀ ਤੁਹਾਨੂੰ ਖਾਣ 'ਚ ਵੀ ਬਹੁਤ ਵਧੀਆ ਹੋਵੇਗਾ ਪੂਰਾ ਹਾਈਜੀਨ ਹੋਵੇਗਾ ਜੀ ਗਲੱਬਸ ਹੀ ਯੂਸ ਕਰਦੇ ਭਾਅ ਜੀ ਉਹ ਸਾਰੇ ਨਾਲੇ ਖਾਣ 'ਚ ਵੀ ਬਹੁਤ ਟੇਸਟੀ ਹੁੰਦਾ ਵਾ ਚੀਜ਼ ਮਿਠਾਈ ਬਹੁਤ ਵਧੀਆ ਹੁੰਦੀ ਆ ਉਹਨਾਂ ਦੀ ਹੋਰ ਇੱਕ ਕਮਲ ਸਵੀਟ ਆ ਜੀ ਕਮਲ ਸਵੀਟਸ ਵਾਲੇ ਵੀ ਉਹਨਾ ਦੇ ਵੀ ਪਿਓਰ ਦੇਸੀ ਘੀ ਪਰੈਪਰੇਸ਼ਨ ਹੈ ਜੀ ਉਹ ਵੀ ਬਹੁਤ ਵਧੀਆ ਸਾਰਾ ਖਾਣ ਪੀਣ ਦਾ ਸਮਾਨ ਬਣਾਉਦੇ ਆ ਹੋਰ ਇੱਕ ਆਪਣੇ ਬਾਹਰੋ ਬਾਹਰ ਆ ਕੇ ਇੱਕ ਆ ਜਾਂਦੇ ਆ ਜੀ ਜਿਹੜੇ ਆਪਣੇ ਹੈ ਨਵੀਂ ਖੁੱਲੀ ਕਾਸਰ ਬੇਕਰ ਖੁੱਲਿਆ ਜੀ ਨਵੇਂ ਉਹ ਵੀ ਬਹੁਤ ਵਧੀਆ ਚੱਲ ਰਿਹਾ ਅੱਜ ਕੱਲ੍ਹ ਉਹਨਾ ਦਾ ਮੀਨ ਕਿ ਜੋ ਵੀ ਖਾਣ ਪੀਣ ਦਾ ਸਮਾਨ ਬਹੁਤ ਵਧੀਆ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਬਣਾਣ ਦੇਣ ਗੇ ਜੀ ਪੂਰਾ ਇਹ ਫ੍ਰੈਂਡਲੀ ਹੈ ਜੀ ਸਟਾਫ ਵੀ ਕੋਈ ਖਿਝਦਾ ਨਹੀਂ ਹੈ ਜੀ ਓਪਨਿੰਗ ਟਾਈਮ ਭਾਅ ਜੀ ਸਵੇਰੇ ਦਸ ਵਜੇ ਤੋਂ ਲੈ ਕੇ ਸ਼ਾਮ ਅੱਠ ਨੌ ਵਜੇ ਤੱਕ ਹੁੰਦਾ ਉਹਨਾ ਦਾ

ਠੀਕ ਹੈ ਭਾਅ ਜੀ ਠੀਕ ਹੈ ਜੀ ਚਲੋ ਓਕੇ ਬਾਏ ਭਾਅ ਜੀ